ਮੈਨੂੰ ਬਚਪਨ ਤੋਂ ਹੀ ਕਿਤਾਬਾਂ ਪੜ੍ਹਨ ਦਾ ਸ਼ੌਂਕ ਹੈ ਮੈਂ ਬਹੁਤ ਸਾਰੀਆਂ ਕ ਕਿਤਾਬਾਂ ਪੜ੍ਹੀਆਂ ਜਿਵੇਂ ਅ ਕੋਈ ਪੰਜਾਬੀ ਚੁਟਕਲੇ ਵਾਲੀਆਂ ਹੋ ਗਈਆਂ ਕੋਈ ਕਹਾਣੀਆਂ ਹੋ ਗਈਆਂ ਕਵਿਤਾਵਾਂ ਹੋ ਗਈਆਂ ਅਤੇ ਅਤੇ ਲੇਖ ਐਸੇ ਵਗੈਰਾ ਵਾਲੀਆਂ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਅਤੇ ਜੋ ਮੈਨੂੰ ਜਿਨ੍ਹਾਂ ਨੂੰ ਪੜ੍ਹ ਕੇ ਮੇਰੇ ਮਨ ਨੂੰ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਹੈ ਮੇਰਾ ਜਿਹੜਾ ਉਦਾਸ ਮਨ ਹੈ ਬਹੁਤ ਜ਼ਿਆਦਾ ਅੰਦਰੋਂ ਖੁਸ਼ ਹੋ ਜਾਂਦਾ ਹੈ ਅਤੇ ਜਿਸ ਨਾਲ਼ ਜਿਸ ਨਾਲ਼ ਮੈਂ ਹੋਰ ਵੀ ਜ਼ਿਆਦਾ ਪ ਕਿਤਾਬਾਂ ਨੂੰ ਪੜ੍ਹਨ ਦੇ ਲਈ ਉਤਸ਼ਾਹਿਤ ਹੁੰਦੀ ਹਾਂ ਮੈਂ ਪਹਿਲਾਂ ਕਿਤਾਬਾਂ ਖਰੀਦ ਕੇ ਪੜ੍ਹਦੀ ਹੁੰਦੀ ਸੀ ਫਿਰ ਦਸਵੀਂ ਕਲਾਸ ਤੋਂ ਮੇਰੀ ਸਕੂਲ ਵਿੱਚ ਲਾਈਬਰੇਰੀ ਹੁੰਦੀ ਸੀ ਫਿਰ ਮੈਂ ਉਥੋਂ ਬੁੱਕਸ ਇਸ਼ੂ ਕਰਕੇ ਬਹੁਤ ਸਾਰੀਆਂ ਬੁੱਕਸ ਪੜ੍ਹੀਆਂ ਫਿਰ ਆਪਣੀ ਪੜ੍ਹਾਈ ਕੰਪਲੀਟ ਹੋਣ ਤੋਂ ਬਾਅਦ ਮੈਂ ਪਿੰਨ ਪਿੰਡ ਵਾਲੀ ਲਾਈਬ੍ਰੇਰੀ ਤੋਂ ਬੁੱਕਸ ਇਸ਼ੂ ਕਰਦੀ ਅਤੇ ਉੱਥੋਂ ਬਹੁਤ ਸਾਰੀਆਂ ਬੁੱਕਸ ਪੜ੍ਹਦੀ ਹੁੰਦੀ ਸੀ ਮੈਨੂੰ ਇਤਿਹਾਸ ਨਾਲ ਰਿਲੇਟਡ ਬਹੁਤ ਸਾਰੀਆਂ ਬੁੱਕਸ ਪੜ੍ਹਨੀਆਂ ਪਸੰਦ ਹੈ ਮੈਂ ਇਤਿਹਾਸ ਨਾਲ ਰਿਲੇਟਡ ਗੁਰ ਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਅਤੇ ਗੁਰੂ ਤੇਗ ਬਹਾਦਰ ਚਾਰ ਸਾਹਿਬਜ਼ਾਦੇ ਆਦਿ ਬਾਰੇ ਪੜ੍ਹਿਆ ਹੈ ਜਿਨ੍ਹਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਅਤੇ ਗੁਰੂ ਨਾਨਕ ਦੇਵ ਜੀ ਬਾਰੇ ਉਹਨਾਂ ਦੀਆਂ ਚਾਰ ਉਦਾਸੀਆਂ ਸੱਚਾ ਸੌਦਾ ਆਦਿ ਇਹਨਾਂ ਸਭ ਬਾਰੇ ਪੜ੍ਹਿਆ ਹੈ ਅਤੇ ਇਹ ਸਾਨੂੰ ਬਹੁਤ ਕੁਝ ਸਿਖਾਉਂਦਾ ਹੈ ਇਹਨਾਂ ਕਿਤਾਬਾਂ ਦੇ ਥਰੂ ਅਸੀਂ ਸਿੱਖਣ ਦੇ ਨਾਲ਼ ਨਾਲ਼ ਆਪਣੀ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਨੂੰ ਵੀ ਹੱਲ ਕਰ ਲੈਂਦੇ ਹਾਂ